ਸਤਿ ਸ਼੍ਰੀ ਅਕਾਲ ਜੀ ਫਲਿੱਪਕਾਰਟ ਤੋਂ ਬੋਲਦੇ ਹੈ ਮੈਂ ਨਾਂ ਹਫਤਾ ਕੁ ਪਹਿਲਾਂ ਇੱਕ ਓਡਰ ਕੀਤਾ ਸੀਗਾ ਬੋਟ ਦੇ ਹੈੱਡਫੋਨ ਪਹਿਲਾਂ ਪੰਦਰਾ ਕ ਦਿਨ ਤਾਂ ਉਹ ਬਹੁਤ ਵਧੀਆ ਚੱਲੇ ਅਤੇ ਹੁਣ ਹੁਣ ਇੱਕ ਹਫਤੇ ਤੋਂ ਮੈਨੂੰ ਪ੍ਰੋਬਲਮ ਆਉਣ ਲੱਗ ਗਈ ਹੈ ਉਹਦੇ ਵਿੱਚ ਅਤੇ ਉਸ ਦਾ ਬੈਟਰੀ ਬੈਕਅੱਪ ਪਹਿਲਾਂ ਤਾਂ ਵੀਹ ਘੰਟੇ ਸੀਗਾ ਅਤੇ ਹੁਣ ਅੱਠ ਘੰਟੇ ਹੀ ਰਹਿ ਗਿਆ ਅਤੇ ਕੰਫਰਟੇਬਲ ਪਹਿਲਾਂ ਮੈਨੂੰ ਇੱਦਾਂ ਲੱਗਦਾ ਸੀਗਾ ਵੀ ਉਹ ਲਾਈਟ ਵੇਟ ਨੇ ਅਤੇ ਹੁਣ ਹੁਣ ਇੰਨੇ ਹੈਵੀ ਲੱਗਦੇ ਅਤੇ ਮੇਰੇ ਕੰਨ ਦਰਦ ਕਰਨ ਲੱਗ ਜਾਂਦੇ ਆ ਮੈਨੂੰ ਤਾਂ ਇੱਦਾਂ ਲੱਗਦਾ ਮੈਂ ਆਪਣੇ ਪੈਸੇ ਖਰਾਬ ਕਰ ਲਏ ਅਤੇ ਟ ਸਮਾਂ ਵੀ ਖਰਾਬ ਕੀਤਾ ਤੁਹਾਡੇ ਕੋਲ ਓਡਰ ਕਰਕੇ